ਪੇਂਡੂ ਖੇਡਾਂ ਵਿੱਚ ਖੇਡਾਂ ਦਾ ਬਹੁਤ ਹੀ ਜਿਹੜਾ ਮਹੱਤਵ ਆ ਦੇਖੋ ਪਿੰਡ ਦੇ ਲੋਕ ਜਿਹੜੇ ਆ ਉਹਨਾਂ ਦੀ ਇੱਕ ਖੇਡ ਆ ਦੇਖੋ ਕਬੱਡੀ ਉਹ ਕੀ ਆ ਐਡੇ ਕੁ ਜ਼ਿਆਦਾ ਉਹ ਨੂੰ ਉਤਸ਼ਾਹ ਦੇ ਨਾਲ ਖੇਡਦੇ ਨੇ ਦੇਖੋ ਪੁਰਾਣਕ ਜਿਹੜੇ ਹਿਸਟਰੀ ਆਪਾਂ ਵੇਖ ਲਈਏ ਇਤਿਹਾਸ ਵੇਖ ਲਈਏ ਤਾਂ ਉਹਦੇ ਵਿੱਚ ਕੀ ਹੈ ਕਬੱਡੀ ਨੂੰ ਦੇ ਵਿੱਚ ਜਿਹੜੇ ਬਹੁਤ ਵੱਡੇ ਵੱਡੇ ਜਿਹੜੇ ਪਹਿਲਵਾਨ ਹੋਏ ਨੇ ਪਹਿਲਾਂ ਤਾਂ ਇਸ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਸਾ ਜਾਂਦੀ ਸੀਗੀ ਪਰ ਹੁਣ ਅੱਗੇ ਅੱਗੇ ਉਹਨਾਂ ਨੂੰ ਇਹ ਹੁੰਦਾ ਕਿ ਜਿੰਨਾ ਜ਼ਿਆਦਾ ਮਤਲਬ ਜਿਹੜੇ ਨੌਜਵਾਨ ਆ ਉਹ ਜਿਹੜੇ ਖੇਡਾਂ ਦੇ ਵਿੱਚ ਆਉਣਗੇ ਉਨੀ ਜ਼ਿਆਦਾ ਜਿਹੜੀ ਆਪਣੇ ਪੰਜਾਬ ਦਾ ਜਿਹੜਾ ਵਾ ਨਾਮ ਹੋਏਗਾ ਬਾਹਰ ਜਾ ਕੇ ਵੀ ਬਾ ਦੂਜੇ ਦੇਸ਼ਾਂ ਵਿੱਚ ਵੀ ਇਹਦੇ ਨਾਲ ਕੀ ਹੈ ਜਿਹੜੇ ਲੋਕ ਆ ਹੁਣ ਦੇਖੋ ਗਰਾਊਂਡਾਂ ਦੇ ਵਿੱਚ ਹੀ ਜਾਣਗੇ ਜਿਹੜੇ ਖਿਡਾਰੀ ਨੇ ਇਹਨਾਂ ਦੀ ਇਹ ਪ੍ਰੈਕਟਿਸ ਕਰਨਗੇ ਹੈ ਨਾ ਅਤੇ ਉਹਦੇ ਨਾਲ ਕੀ ਹੈ ਜਿਹੜੇ ਦੂਰੋਂ ਦੂਰੋਂ ਲੋਕ ਉਹਨਾਂ ਨੂੰ ਵੇਖਣ ਆਉਣਗੇ ਅਤੇ ਇਹਦੇ ਨਾਲ ਕੀ ਆ ਉਹਨਾਂ ਦੀ ਆਪਸੀ ਇੱਕ ਜਿਹੜੀ ਸਾਂਝ ਉਹ ਬਣੀ ਰਹੇਗੀ ਮਾਨਸਿਕ ਰੋਗਾਂ ਦੂਰ ਹੈਗੇ ਅਤੇ ਇੱਕ ਇਹ ਕਿ ਜਿਹੜੀ ਖੇਡਾਂ ਨੇ ਹਾਕੀ ਹੋ ਗਿਆ ਫੁੱਟਬਾਲ ਇਹ ਜਿਹੜੀਆਂ ਖੇਡਾਂ ਆ ਇਹ ਇੱਕ ਮਨੋਰੰਜਨ ਦਾ ਸਾਧਨ ਆ ਪੇਂਡੂ ਲੋਕਾਂ ਵਿੱਚ ਅਤੇ ਇਹਦੇ ਕਰਕੇ ਕੀ ਹੈ ਕਿ ਉਹ ਚਾਹੁੰਦੇ ਆ ਕਿ ਉਤਸ਼ਾਹਿਤ ਹੁੰਦੇ ਆ ਕਿ ਸਾਡੇ ਬੱਚੇ ਵੀ ਵੱਧ ਤੋਂ ਵੱਧ ਜਿਹੜੇ ਇਸ ਖੇਤਰ ਵਿੱਚ ਆਉਣ ਅਤੇ ਵੱਧ ਤੋਂ ਵੱਧ ਜੀਵਨ ਵਿੱਚ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਹਾਸਲ ਕਰਨ ਇਹਦੇ ਨਾਲ ਨਾਲ ਕੀ ਆ ਕਿ ਜਿਹੜਾ ਇੱਕ ਨੌਜਵਾਨ ਆ ਜਾਂ ਦੂਜਾ ਕੋਈ ਵੀ ਲਾ ਲਓ ਇਹਦਾ ਕੋਈ ਵੀ ਜਿਹੜੀ ਅ ਉਮਰ ਦੀ ਜਿਹੜੀ ਹੁੰਦੀ ਨਹੀਂ ਆ ਕਿ ਕਿੰਨਾ ਕੋਈ ਖੇਡ ਸਕਦਾ ਜਾਂ ਨਹੀਂ ਇਹ ਕੋਈ ਵੀ ਜਿਹੜੀ ਉਮਰ ਦਾ ਬੰਦਾ ਜਿਹੜਾ ਇਹ ਖੇਡਾਂ ਖੇਡ ਸਕਦਾ ਵਾ ਇਹਦੇ ਨਾਲ ਮਾਨਸਿਕ ਅਤੇ ਸਰੀਰਕ ਜਿਹੜੀ ਤੰਦਰੁਸਤੀ ਉਹਨਾਂ ਨੂੰ ਮਿਲ ਮਿਲਦੀ ਆ